ਪੰਜਾਬ ਵਿੱਚ ਰਾਜਨੀਤਿਕ ਪ੍ਰਣਾਲੀ ਸ਼ਕਤੀ ਦੇ ਲਈ ਸਰਕਾਰ ਬਹੁਤ ਸਾਰੇ ਉਪਰਾਲੇ ਕਰਦੀ ਆ ਅਸੀਂ ਜਿਵੇਂ ਕਿ ਲੁਧਿਆਣਾ ਸ਼ਹਿਰ ਵਿੱਚ ਰਹਿ ਰਹੇ ਹਾਂ ਉੱਥੇ ਸਾਈਕਲਾਂ ਦੇ ਪਾਰਟ ਵਗੈਰਾ ਸਿਲਾਈ ਮਸ਼ੀਨਾਂ ਦੇ ਪਾਟ ਬਣਦੇ ਨੇ ਅਤੇ ਇਹਨਾਂ ਨੂੰ ਕੰਮ ਦੇ ਲਈ ਰੋਜ਼ਗਾਰ ਲੈਣ ਲਈ ਸਰਕਾਰ ਕੋਲੋਂ ਸਾਨੂੰ ਕਾਫੀ ਮਦਦ ਮਿਲ ਰਹੀ ਆ ਲੋਨ ਵਗੈਰਾ ਵੀ ਮਿਲ ਜਾਂਦੇ ਨੇ ਅਤੇ ਸਮਾਨ ਨੂੰ ਇੱਧਰ ਉੱਧਰ ਆਯਾਤ ਜਾਂ ਨਿਰਯਾਤ ਕਰਨ ਲਈ ਸਾਨੂੰ ਟੈਕਸ ਵਗੈਰਾ ਮੁਆਫ ਵੀ ਕਰੇ ਜਾਂਦੇ ਨੇ ਅਤੇ ਇਸ ਇਸ ਨਾਲ ਸਰਕਾਰ ਦੀ ਵੀ ਬਹੁਤ ਮਦਦ ਹੋ ਜਾਂਦੀ ਆ ਅਤੇ ਬਾਕੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਆ ਜਿੱਥੇ ਕਿ ਜਿਹਨਾਂ ਜਿਹੜੇ ਸ਼ਹਿਰ ਨੂੰ ਅਸੀਂ ਗੋਲਡਨ ਟੈਂਪਲ ਵੀ ਕਹਿ ਦਿੰਦੇ ਹਾਂ ਉੱਥੇ ਵੀ ਬਾਹਰੋਂ ਬਹੁਤ ਸਾਰੇ ਟੂਰਿਸਟ ਆ ਕੇ ਇੱਥੇ ਸੈਰ ਘੁੰਮ ਫਿਰ ਜਾਂਦੇ ਨੇ ਅਤੇ ਖਾਣਾ ਪਾਣੀ ਖਾ ਕੇ ਜਾਂਦੇ ਨੇ ਇਸ ਨਾਲ ਵੀ ਸਰਕਾਰ ਦੀ ਕਾਫੀ ਉਪਰਾਲੇ ਕਰਦੇ ਨੇ ਸਾਨੂੰ ਠੀਕ ਲੱਗਦੇ ਨੇ ਅਤੇ ਜਲੰਧਰ ਸ਼ਹਿਰ ਆ ਜਿਵੇਂ ਜਲੰਧਰ ਸ਼ਹਿਰ ਕੱਪੜੇ ਲਈ ਬਹੁਤ ਵਧੀਆ ਹੈ